ਮੇਰੇ ਮਨਪਸੰਦ ਘੋੜੇ ਦੀ ਨਸਲ ਅਰਬੀ ਨਸਲ ਹੈ ਇਹ ਘੋੜੇ ਬਹੁਤ ਹੀ ਜ਼ਿਆਦਾ ਦੌੜਦੇ ਹਨ ਬਹੁ ਇਹ ਘੋੜੇ ਬਹੁਤ ਹੀ ਸ਼ਾਨਦਾਰ ਹੁੰਦੇ ਹਨ ਇਹਨਾਂ ਦੀ ਕੱਦ ਕਾਠੀ ਵੀ ਬਹੁਤ ਹੀ ਜ਼ਿਆਦਾ ਉੱਚੀ ਹੁੰਦੀ ਹੈ ਇਹ ਦੇਖਣ ਨੂੰ ਬਹੁਤ ਹੀ ਜ਼ਿਆਦਾ ਸੋਹਣੇ ਹੁੰਦੇ ਹਨ ਮੇਰੇ ਕੋਲ ਦੋ ਘੋੜੇ ਹਨ ਇਹ ਘੋੜੇ ਭੱਜਣ ਦੇ ਵਿੱਚ ਬਹੁਤ ਹੀ ਜ਼ਿਆਦਾ ਮਾਹਰ ਹਨ ਮੈਂ ਜਦੋਂ ਜਦੋਂ ਵੀ ਕੋਈ ਇਥ ਮੇਰੇ ਜ਼ਿਲ੍ਹੇ ਦੇ ਵਿੱਚ ਕੋਈ ਖੇਡ ਮੇਲਾ ਹੁੰਦਾ ਹੈ ਤਾਂ ਮੈਂ ਆਪਣੇ ਘੋੜੇ ਨੂੰ ਜ਼ਰੂਰ ਲੈ ਕੇ ਜਾਂਦਾ ਹਾਂ ਇਹ ਹਰ ਸਾਲ ਅੱਵਲ ਆਉਂਦਾ ਹੈ ਮੇਰਾ ਘੋੜਾ ਬਹੁਤ ਹੀ ਸ਼ਾਨਦਾਰ ਹੈ ਇਹਨੇ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੋਇਆ ਹੈ ਮੇਰੇ ਘੋੜੇ ਨੂੰ ਕਾਫੀ ਲੋਕ ਪਸੰਦ ਕਰਦੇ ਹਨ ਉਹ ਬਹੁਤ ਜ਼ਿਆਦਾ ਦੇਖਣ ਆਉਂਦੇ ਹਨ ਅਤੇ ਫੋਟੋਆਂ ਕਰਵਾਉਂਦੇ ਹਨ ਅਤੇ ਵੀਡੀਓ ਬਣਾਉਂਦੇ ਹਨ ਮੈਂ ਆਪਣੇ ਘੋੜੇ ਦੀ ਬਹੁਤ ਹੀ ਜ਼ਿਆਦਾ ਸਾਂਭ ਸੰਭਾਲ ਕਰਦਾ ਹਾਂ ਮੈਂ ਇਸ ਨੂੰ ਡੇਲੀ ਨਹਿਲਾਉਂਦਾ ਹਾਂ ਅਤੇ ਇਸਨੂੰ ਐਨ ਪੂਰੀ ਵਧੀਆ ਖੁਰਾਕ ਪਾਉਂਦਾ ਹਾਂ ਇਹ ਨਸਲ ਬਹੁਤ ਹੀ ਸ਼ਾਨਦਾਰ ਨਸਲ ਹੈ ਇਹ ਘੋੜੇ ਦੇਖਣ ਦੇ ਵਿੱਚ ਵੀ ਬਹੁਤ ਜ਼ਿਆਦਾ ਸੋਹਣੇ ਹੁੰਦੇ ਹਨ ਮੇਰੇ ਕੋਲ ਇੱਕ ਕਾਲਾ ਅਤੇ ਇੱਕ ਚਿੱਟੇ ਰੰਗ ਦਾ ਘੋੜਾ ਹੈ ਦੋਹੇਂ ਘੋੜੇ ਬਹੁਤ ਹੀ ਜ਼ਿਆਦਾ ਸ਼ਾਨਦਾਰ ਹਨ